ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਨੂੰ ਟੈਲੀਵਿਜ਼ਨ 'ਤੇ ਕੋਈ ਵੀ ਨਾਟਕ ਦੇਖਣਾ ਕਿੰਨਾ ਜ਼ਿਆਦਾ ਪਸੰਦ ਹੈ ਅਤੇ ਇਹਨਾਂ ਨਾਟਕਾਂ ਵਿੱਚੋਂ ਮੈਨੂੰ ਸਭ ਤੋਂ ਜ਼ਿਆਦਾ ਜਿਹੜਾ ਨਾਟਕ ਪਸੰਦ ਹੈ ਉਹ ਹੈ ਅਨੁਪਮਾ ਅਨੁਪਮਾ ਵਿੱਚ ਇੱਕ ਅਨੁਪਮਾ ਵਿੱਚ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਔਰਤ ਪਹਿਲਾਂ ਆਪਣੇ ਅਰਮਾਨਾਂ ਨੂੰ ਮਾਰ ਕੇ ਆਪਣੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਕੇ ਇੱਕ ਅਣਜਾਣ ਵਿਅਕਤੀ ਨਾਲ਼ ਵਿਆਹ ਕਰਾ ਲੈਂਦੀ ਹੈ ਪਰ ਉਹ ਵਿਅਕਤੀ ਨੂੰ ਸਹੀ ਤਰ੍ਹਾਂ ਜਾਣਦੀ ਵੀ ਨਹੀਂ ਹੁੰਦੀ ਉਹ ਆਪਣੇ ਮਾਂ ਪਿਓ ਦੇ ਕਹਿਣ 'ਤੇ ਉਹਦੇ ਨਾਲ਼ ਵਿਆਹ ਕਰਵਾਉਂਦੀ ਹੈ ਉਸਨੂੰ ਨਹੀਂ ਪਤਾ ਕਿ ਉਸ ਦੇ ਨਾਲ਼ ਕੀ ਹੋਏਗਾ ਅਤੇ ਉਸ ਵਿੱਚ ਬਾਅਦ ਵਿੱਚ ਉਹ ਔਰਤ ਦੇ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਉਹ ਉਸ ਨਾਲ਼ ਨਫਰਤ ਕਰਦੇ ਹਨ ਕਿ ਇਹਦੀ ਡਰੈਸਿੰਗ ਸੈਂਸ ਨਹੀਂ ਹੈ ਇਸਨੂੰ ਅਕਲ ਨਹੀਂ ਹੈ ਇਹ ਐਜੂਕੇਟਿਡ ਨਹੀਂ ਹੈ ਪੜ੍ਹੀ ਲਿਖੀ ਨਹੀਂ ਹੈ ਇਸਨੂੰ ਬਿਲਕੁਲ ਵੀ ਤਮੀਜ਼ ਨਹੀਂ ਹੈ ਕਿ ਮੇਰੇ ਪੇ ਮੇਰੇ ਫਰੈਂਡਸ ਨਾਲ਼ ਕਿੱਦਾਂ ਬਿਹੇਵ ਕਰਨਾ ਹੈ ਪਰ ਉਹ ਮਾਂ ਦੇ ਦਿਲ 'ਤੇ ਜੋ ਬੀਤਦੀ ਹੈ ਉਹ ਕੋਈ ਨਹੀਂ ਜਾਣ ਸਕਦਾ ਉਸ ਸ਼ੋਅ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇੱਕ ਲੜਕੀ ਜਦ ਆਪਣੇ ਪੈਰਾਂ 'ਤੇ ਸਟੈਂਡ ਹੋਣਾ ਚਾਹੁੰਦੀ ਹੈ ਤਾਂ ਉਸ ਦੇ ਰਾਹ ਵਿੱਚ ਕਿੰਨੀਆਂ ਰੁਕਾਵਟਾਂ ਆਉਂਦੀਆਂ ਹਨ ਪਰ ਉਹ ਸਾਰੀਆਂ ਰੁਕਾਵਟਾਂ ਨੂੰ ਤੋੜ ਕੇ ਅੱਗੇ ਲੰਘਦੀ ਹੈ ਜਦ ਉਹ ਅੱਗੇ ਲੰਘਦੀ ਹੈ ਤਦ ਵੀ ਉਸਦਾ ਜਿਹੜਾ ਸਹੁਰਾ ਪਰਿਵਾਰ ਹੁੰਦਾ ਹੈ ਉਹ ਉਸਦਾ ਪਿੱਛਾ ਨਹੀਂ ਛੱਡਦਾ ਅਤੇ ਉਸਦੇ ਰਾਹ ਵਿੱਚ ਰੁਕਾਵਟਾਂ ਬਣਿਆ ਰਹਿੰਦਾ ਹੈ ਪਰ ਜਦ ਆਖਿਰਕਾਰ ਉਹਦੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਹੀ ਵਾਲੀਆਂ ਹੁੰਦੀਆਂ ਹਨ ਜਾਂ ਆ ਜਾਂਦੀਆਂ ਹਨ ਤਾਂ ਉਹਦਾ ਸਹੁਰਾ ਪਰਿਵਾਰ ਉਹਦੇ ਸਾਹਮਣੇ ਇੱਦਾਂ ਨਾਟਕ ਕਰਦਾ ਹੈ ਜਿਵੇਂ ਕਿ ਉਹ ਉਸਦੇ ਪਿੱਛੇ ਮਰ ਹੀ ਚੱਲੇ ਹੋਣ ਪਰ ਅਸਲੀਅਤ ਇੱਦਾਂ ਕੁਝ ਨਹੀਂ ਹੁੰਦੀ ਅਗਰ ਉਹ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਖੁਸ਼ ਨਹੀਂ ਹੈ ਤਾਂ ਉਸਨੂੰ ਉਨ੍ਹਾਂ ਦੇ ਨਾਲ਼ ਨਹੀਂ ਰਹਿਣਾ ਚਾਹੀਦਾ ਪਰ ਅਨੁਪਮਾ ਸ਼ੋਅ ਦੇ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਸਾਨੂੰ ਆਪਣੇ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਚਾਹੇ ਉਹ ਅਗਰ ਉਹ ਗਲਤ ਹੋਣ ਤਾਂ ਉਹਨਾਂ ਨੂੰ ਦੱਸੋ ਪਰ ਉਹਨਾਂ ਨਾਲ਼ ਇਸ ਤਰ੍ਹਾਂ ਦਾ ਬਿਹੇਵ ਨਾ ਕਰੋ ਕਿ ਜਿਵੇਂ ਤੁਸੀਂ ਉਹਨਾਂ ਦੇ ਕੁਝ ਲੱਗਦੇ ਹੀ ਨਹੀਂ ਆਖਿਰਕਾਰ ਉਸਨੇ ਇਹ ਵੀ ਦੱਸਿਆ ਹੈ ਕਿ ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਚਾਹੇ ਜੋ ਵੀ ਕੁਛ ਹੋਜੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਹੀ ਵੱਧਦੇ ਰਹਿਣਾ ਚਾਹੀਦਾ ਹੈ ਕਦੇ ਵੀ ਕਿਸੇ ਵੱਲ ਦੇਖ ਕੇ ਸੜਨਾ ਨਹੀਂ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਾਂਗੇ ਤਾਂ ਹੀ ਸਕਸੈੱਸਫੁਲ ਹੋਵਾਂਗੇ ਅਤੇ ਦੂਜਿਆਂ ਦੀ ਖੁਸ਼ੀ ਨੂੰ ਵੇਖ ਕੇ ਖੁਸ਼ ਰਹਿਣਾ ਚਾਹੀਦਾ ਹੈ